ਸਾਡੇ ਘਰ ਦੇ ਸਾਹਮਣੇ ਗੁਰਦੁਆਰਾ ਹੈ ਇਸ ਕਰਕੇ ਆਲਾ ਦੁਆਲਾ ਸਾਫ਼ ਕਰਾਉਣਾ ਸਾਡਾ ਬਹੁਤ ਜ਼ਰੂਰੀ ਹੈ ਅਸੀਂ ਦੋ ਟੈਮ ਝਾੜੂ ਲਵਾਉਨੇ ਹਾਂ ਨਾਲ ਪਾਣੀ ਧਰੋਕਿਆਂ ਜਾਂਦਾ ਹੈ ਅਤੇ ਕੂੜੇ ਵਾਲੇ ਡੱਬੇ ਰੱਖੇ ਹੋਏ ਹਨ ਅਤੇ ਨਾਲ ਲਾਗੇ ਲਾਗੇ ਅਸੀਂ ਪੌਦੇ ਵੀ ਲਗਾਏ ਹੋਏ ਨੇ ਫੁੱਲਾਂ ਦੇ ਰੁੱਖ ਵੀ ਨੇ ਅਤੇ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਵੀ ਚੰਗਾ ਕੀਤਾ ਹੋਇਆ ਹੈ